ਸਲਾਨਾ ਯਾਤਰਾ ਮੇਲਾ ਸਾਡਾ ਹੈਗਾ ਹੈ ਵਿਸਾਖੀ ਦਾ ਮੇਲਾ ਜਿਹੜਾ ਕਿ ਤੇਰਾਂ ਅਪ੍ਰੈਲ ਨੂੰ ਲੱਗਦਾ ਹਰ ਸਾਲ ਤੇਰਾਂ ਅਪ੍ਰੈਲ ਨੂੰ ਮਨਾਇਆ ਜਾਂਦਾ ਅਤੇ ਇਹਦੇ ਨਾਲ ਰਿਲੇਟਡ ਮੇਰੀ ਇੱਕ ਬਚਪਨ ਦੀ ਯਾਦ ਹੈਗੀ ਹੈ ਕੀ ਹੋਇਆ ਕਿ ਸਾਡੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਮੇਲੇ 'ਤੇ ਜਾਈਦਾ ਜ਼ਰੂਰ ਉੱਥੇ ਰਾਗੀ ਢਾਡੀ ਵੀ ਆਉਂਦੇ ਨੇ ਅਤੇ ਉੱਥੇ ਖਾਣ ਵਾਲੀਆਂ ਚੀਜ਼ਾਂ ਬੜੀਆਂ ਮਿਲਦੀਆਂ ਨੇ ਖਰੀਦਣ ਲਈ ਖਿਡੌਣੇ ਹੁੰਦੇ ਨੇ ਝੂਟੇ ਹੁੰਦੇ ਨੇ ਸਾਰੇ ਅਤੇ ਅਸੀਂ ਗਏ ਛੋਟੀ ਹੁੰਦੀ ਸਾਂ ਮੈਂ ਸਾਡੇ ਨਾਲ ਸਾਰੇ ਗੱਲਾਂ ਕਰਦੇ ਸਨ ਅਸੀਂ ਮੇਲੇ 'ਤੇ ਜਾ ਕੇ ਨਾ ਚੰਡੋਲ 'ਤੇ ਚੜ੍ਹਨਾ ਅੱਛਾ ਹੁਣ ਚੰਡੋਲ ਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਚੰਡੋਲ ਹੁੰਦਾ ਕੀ ਹੈ ਕਿਉਂਕਿ ਮੈਂ ਛੋਟੀ ਜਿਹੀ ਹੁੰਦੀ ਸਾਂ ਉੱਥੇ ਮਤਲਬ ਚੀਜ਼ਾਂ ਚੁਜ਼ਾਂ ਖਰੀਦੀਆਂ ਅਸੀਂ ਉਸ ਤੋਂ ਬਾਅਦ ਨਾ ਸਾਰੇ ਕਹਿਣ ਚੰਡੋਲ ਚੜ੍ਹਨਾ ਚੰਡੋਲ ਚੜ੍ਹਨਾ ਮੈਂ ਵੀ ਰੌਲਾ ਪਾ ਲਿਆ ਮੈਂ ਕਿਹਾ ਮੈਂ ਵੀ ਚੜ੍ਹਨਾ ਇੰਨੇ ਮੇਰੇ ਮਮੀ ਹੋਣੀ ਕਹਿਣ ਵੀ ਉਹ 'ਤੇ ਨਹੀ ਚੜ੍ਹਿਆ ਜਾਣਾ ਤੇਰੇ ਕੋਲੋਂ ਮੈਂ ਕਿਹਾ ਨਹੀਂ ਸਾਰਿਆਂ ਨੇ ਚੜ੍ਹਨਾ ਮੈਂ ਵੀ ਚੜ੍ਹਨਾ ਠੀਕ ਹੈ ਮੈਂ ਜਿੱਦ ਜਿਹੀ ਕਰਕੇ ਬਾਈ ਚੱਲੋ ਮਮੀ ਉਰਾਂ ਨੇ ਕਿਹਾ ਵੀ ਹਾਂ ਚੱਲ ਜਿੱਦ ਕਰਦੀ ਬਿਠਾ ਦਿਓ ਬਈ ਅੱਛਾ ਉਹ 'ਤੇ ਬਿਠਾ ਲਿਆ ਮੈਂ ਮੇਰੇ ਮਾਮਾ ਜੀ ਦੀ ਗੋਦੀ 'ਚ ਬੈਠੀ ਸਾਂ ਉਹ ਵੀ ਆਏ ਸਨ ਵੇਖਣ ਵਾਸਤੇ ਮੇਲਾ ਅਤੇ ਉਹਨਾਂ ਦੀ ਗੋਦੀ 'ਚ ਬੈਠੀ ਸਾਂ ਜਦੋਂ ਚੰਡੋਲ ਵਾਲਾ ਉਹ ਝੂਟਾ ਚੱਲਿਆ ਮੈਨੂੰ ਦੇਸ ਚੱਲ ਉਂਝ ਹੀ ਘੁੰਮਿਆ ਉਹ ਹੌਲੀ ਹੌਲੀ ਕੁਛ ਨਹੀਂ ਹੁੰਦਾ ਵੀ ਝੂਠੇ ਮਿਲਣਗੇ ਹੈ ਨਾ ਜਦੋਂ ਉਹ ਚੱਲਿਆ ਉਹਨੇ ਤਾਂ ਉੱਪਰ ਜਾਣਾ ਸੀ ਮੈਂ ਤਾਂ ਉਹ ਚੀਕਾਂ ਮਾਰਨ ਲੱਗ ਗਈ ਚੀਕਾਂ ਮਾਰਨ ਲੱਗ ਗਈ ਮੈਨੂੰ ਉਲਟੀਆਂ ਲੱਗ ਗਈਆਂ ਮੈਨੂੰ ਤਾਂ ਇਕ ਦਮ ਉਲਟੀ ਵੀ ਆ ਗਈ ਅਤੇ ਫਿਰ ਉਹਨੇ ਜਿਹੜਾ ਚਲਾਉਣ ਵਾਲਾ ਸੀ ਉਹਨੇ ਬੰਦ ਕੀਤਾ ਸਾਰੇ ਲੋ ਸਾਰੇ ਜਦੋਂ ਚੀਕਾਂ ਮਾਰਨ ਲੱਗ ਗਏ ਉੱਚੀ ਉੱਚੀ ਉਹਨਾਂ ਨੇ ਮੇਰੇ ਮਾਮਾ ਜੀ ਹੋਰਾਂ ਨੇ ਵੀ ਰੌਲਾ ਪਾ ਤਾ ਇਹਨੂੰ ਕੁਛ ਹੋ ਜਾਣਾ ਵੀ ਬੰਦ ਕਰੋ ਫਿਰ ਉਹਨਾਂ ਮਸਾਂ ਮਸਾਂ ਬੰਦ ਕੀਤਾ ਅਤੇ ਮੇਰੀ ਜਾਨ 'ਚ ਜਾਨ ਆਈ ਅਤੇ ਉਸ ਤੋਂ ਬਾਅਦ ਮੈਂ ਅੱਜ ਤੱਕ ਨਹੀਂ ਕਦੇ ਕਿਹਾ ਮੈਂ ਚੰਡੋਲ 'ਤੇ ਚੜ੍ਹਨਾ ਕਿਉਂਕਿ ਮੈਨੂੰ ਉਦੋਂ ਦਾ ਡਰ ਹੀ ਲੱਗਿਆ ਪਿਆ ਬਸ ਫਿਰ ਉਹ ਡਰ ਕਰਕੇ ਮੈਂ ਕਰ ਹੀ ਨਹੀਂ ਪਾਈ ਬਸ ਉਸ ਤੋਂ ਬਾਅਦ ਕਦੇ ਚੜ੍ਹੀ ਹੀ ਨਹੀਂ ਚੰਡੋਲ 'ਤੇ